ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਅ ਜੀ ਰੰਧਾਵਾ ਫਰਨੀਚਰ ਹਾਊਸ ਤੋਂ ਬੋਲਦੇ ਜੀ ਰੰਧਾਵਾ ਹਾਂਜੀ ਭਾਅ ਜੀ ਆਪਣੇ ਕੋਲ ਫਰਨੀਚਰ ਪੁਰਾਣਾ ਪਿਆ ਸੀਗਾ ਤਾਂ ਉਹ ਰਿਪੇਅਰ ਜਿੱਦਾਂ ਕਰਵਾਉਣਾ ਸੀਗਾ ਆਪਣੇ ਕੋਲ ਪੁਰਾਣੇ ਬੈਡ ਪਏ ਆ ਅਤੇ ਡਾਇਨਿੰਗ ਟੇਬਲ ਪੁਰਾਣਾ ਪਿਆ ਹੋਇਆ ਉਹ ਰਿਪੇਅਰ ਕਰਵਾਉਣਾ ਸੀ ਹਾਂਜੀ ਹਾਂਜੀ ਨਹੀਂ ਆਪਣੇ ਕੋਲ ਸਿੰਪਲ ਪਏ ਆ ਅਤੇ ਉਹਦੇ ਨਾਲ ਆਪਾਂ ਬੋਕਸ ਬੈਡ ਬਣਵਾਉਣਾ ਹੈ ਜੇ ਉਹਦੇ ਨਾਲ ਕੋਈ ਅਲੱਗ ਸਮਾਨ ਵੀ ਲੱਗਦਾ ਹੋਇਆ ਤਾਂ ਉਹ ਵੀ ਆਪਾਂ ਕਰਵਾਉਣਾ ਹੈ ਹਾ ਮਾਈਕਾ ਮੁਈਕਾ ਲਾ ਕੇ ਹਾਂਜੀ ਵਧੀਆ ਜੀ ਹਾਂਜੀ ਢੋਹ ਵੀ ਬਣਵਾਉਣਾ ਜੀ ਹਾਂਜੀ ਪੋਲਿਸ਼ ਵਗੈਰਾ ਹਾਂਜੀ ਹਾਂਜੀ ਪੋਲਿਸ਼ ਵੀ ਕਰਵਾਉਣੀ ਆ ਅਤੇ ਇਹਦਾ ਐਸਟੀਮੇਟ ਖਰਚਾ ਕੀ ਆ ਆਪਣੇ ਕੋਲ ਦੋ ਚੀਜ਼ਾਂ ਪਈਆਂ ਆ ਇੱਕ ਡਾਇਨਿੰਗ ਟੇਬਲ ਆ ਅਤੇ ਇੱਕ ਬੈਡ ਆ ਹਾਂਜੀ ਛੇ ਛੇ ਕੁਰਸੀਆਂ ਵਾਲਾ ਜੀ ਛੇ ਕੁਰਸੀਆਂ ਵਾਲਾ

ਠੀਕ ਆ ਜੀ ਠੀਕ ਆ ਜੀ

ਠੀਕ ਆ ਜੀ ਠੀ ਨਹੀਂ ਉੱਥੇ ਠੀਕ ਆ ਠੀਕ ਆ ਅਤੇ ਸਰ ਤੁਹਾਡੇ ਕੋਲ ਟਾਈਮ ਹੋਏਗਾ ਤਾਂ ਤੁਸੀਂ ਬੰਦਾ ਭੇਜ ਸਕਦੇ ਹੋ ਉਹ ਘਰੇ ਫਿਰ ਕਿਸੇ ਦਿਨ ਟਾਈਮ ਹੋਇਆ ਤਾਂ ਫਿਰ ਮੈਨੂੰ ਦੱਸ ਦਿਓ ਫਿਰ ਮੈਂ ਤੁਹਾਨੂੰ ਉਸ ਦਿਨ ਭੇਜ ਬੰਦਾ ਬੁਲਵਾ ਲੈਣ ਤੁਸੀਂ ਕੋਈ ਗੱਲ ਨਹੀਂ ਅੱਜ ਸ਼ਾਮ ਤੱਕ ਭੇਜ ਦਿਉ ਨਹੀਂ ਤਾਂ ਫਿਰ ਅੱਜ ਹਾਂਜੀ ਹਾਂਜੀ ਹਾਂਜੀ ਜੀ ਅੱਜ ਸ਼ਾਮ ਤੱਕ ਭੇਜ ਦਿਓ ਜੀ ਠੀਕ ਆ ਭਾਈ ਠੀਕ ਠੀਕ ਆ ਭਾਅ ਜੀ ਠੀਕ ਹੈ ਓਕੇ ਭਾਅ ਜੀ ਓਕੇ ਥੈਂਕ ਯੂ